ਹੈਲੋ ਚਾਵਲਾ ਚਿਕਨ ਤੋਂ ਬੋਲਦੇ ਪਏ ਅੱਜ ਤੁਹਾਡੇ ਕੀ ਖਾਸ ਪਕਵਾਨ ਦਿਨ ਦਾ ਕੀ ਹੈਗਾ ਪਿਛੋਰੀ ਚਿਕਨ ਜਿਹੜਾ ਉਹ ਮਲਾਈ 'ਚ ਬਣਦਾ ਬੜਾ ਸੋਫਟ ਹੁੰਦਾ

ਦੋ ਪਲੇਟਾਂ ਦੋ ਪਲੇਟਾਂ ਆਪਣਾ ਮੈਂ ਔਡਰ ਕਰਦਾਂ ਅਤੇ ਕੀ ਦਿਉਗੇ ਆਪਣਾ ਡਿਸਕਾਊਂਟ ਕੀ ਦਿਉਗੇ ਵੀਹ ਪਰਸੈਂਟ ਅਤੇ ਚਲੋ ਦੋ ਆਪਣਾ ਭੇਜ ਦਿਉ ਨਾਲ ਕਟਲਰੀ ਅਤੇ ਡਿਸਪੋਜਲ ਆਈਟਮ ਵੀ ਭੇਜ ਦੇਣੀ ਆ ਥੈਂਕ ਯੂ